ਮੇਰੀ ਜ਼ਿੰਦਗੀ ਦਾ ਜਿਹੜਾ ਹੈਗਾ ਮਹੱਤਵਪੂਰਨ ਫੈਸਲਾ ਮੇਰਾ ਨੌਕਰੀ ਵਿੱਚ ਆਉਣ ਦਾ ਹੈ ਜਿਹਦੇ ਨਾਲ਼ ਜਿਹੜਾ ਹੈਗਾ ਮੇਰਾ ਘਰ ਦਾ ਗੁਜ਼ਾਰਾ ਬੜੇ ਆਰਾਮ ਨਾਲ਼ ਚੱਲਿਆ ਮੈਂ ਬੱਚਿਆਂ ਦੀ ਪਰਵਰਿਸ਼ ਜਿਹੜੀ ਹੈ ਬਹੁਤ ਚੰਗੀ ਕੀਤੀ ਉਹ ਰੋਜ਼ ਰੁਜ਼ਗਾਰ ਮਿਲਿਆ ਰੁਜ਼ਗਾਰ ਦੇ ਨਾਲ਼ ਕੀ ਹੈ ਕਿ ਘਰ ਦੇ ਗੁਜ਼ਾਰੇ ਦੇ ਨਾਲ਼ ਨਾਲ਼ ਬੱਚਿਆਂ ਦੀ ਐਜੂਕੇਸ਼ਨ ਦਾ ਬਹੁਤ ਫ਼ਰਕ ਪਿਆ ਐਜੂਕੇਸ਼ਨ ਜਿਸ ਤਰ੍ਹਾਂ ਕਿ ਬੱਚੇ ਜਿਹੜੇ ਹੈਗੇ ਆ ਮੈਂ ਆਪਣੇ ਫੋਰਨ ਜਿਹੜੇ ਹੈਗਾ ਉਹਨਾਂ ਨੂੰ ਸੈਟਲ ਕਰਨ ਵਿੱਚ ਜਿਹੜਾ ਹੈਗਾ ਬਹੁਤ ਸਹਾਈ ਹੋਈ ਹਾਂ ਕਿ ਮੇਰਾ ਇਹ ਮੈਨੂੰ ਲੱਗਦਾ ਹੈ ਕਿ ਮੇਰੇ ਲਈ ਇਹ ਬਹੁਤ ਅੱਛਾ ਫ਼ੈਸਲਾ ਸੀ ਜੋਬ ਵਿੱਚ ਆਉਣਾ ਜਿਹਦੇ ਨਾਲ਼ ਮੈਂ ਇੰਡੀਪੈਂਡੈਂਟ ਹੋ ਗਈ ਹਾਂ ਉਹਦੇ ਨਾਲ਼ ਕੀ ਹੈ ਕਿ ਆਪਣੇ ਆਪ ਨੂੰ ਮੈਨੂੰ ਬਹੁਤ ਤਾਕਤ ਮਿਲੀ ਹੈ ਦੁਨੀਆਂ ਵਿੱਚ ਖੜ੍ਹਨ ਦੀ ਤਾਕਤ ਮਿਲੀ ਹੈ ਇਹ ਮੇਰੇ ਲਈ ਸਭ ਤੋਂ ਪੋਜ਼ੀਟਿਵ ਜਿਹੜੀ ਹੈਗੀ ਹੈ ਚੀਜ਼ ਹੈ